ਕੱਲ੍ਹ ਮੈਂ ਅਤੇ ਮੇਰੀ ਘਰਵਾਲੀ ਨੇ ਸ਼੍ਰੀ ਦਰਬਾਰ ਸਾਹਿਬ ਜਾਣ ਦਾ ਪ੍ਰੋਗਰਾਮ ਬਣਾਇਆ ਪਰੰਤੂ ਮੌਕੇ 'ਤੇ ਹੀ ਸਾਡੀ ਗੱਡੀ ਖਰਾਬ ਹੋ ਗਈ ਅਤੇ ਮੇਰੀ ਮਿਸਿਜ ਨੇ ਇੱਕ ਔਨਲਾਈਨ ਟੈਕਸੀ ਬੁੱਕ ਕਰਨ ਦਾ ਫੁਰਨਾ ਬਣਾਇਆ ਅਤੇ ਉਸ ਨੇ ਟੈਕਸੀ ਬੁੱਕ ਕੀਤੀ ਸਾਡੇ ਦੱਸੇ ਪਤੇ 'ਤੇ ਟੈਕਸੀ ਡਰਾਈਵਰ ਪੰਜਾਂ ਮਿੰਟਾਂ ਬਾਅਦ ਟੈਕਸੀ ਲੈ ਕੇ ਆ ਗਿਆ ਅਸੀਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਨਮਸਕਾਰ ਕਰਕੇ ਪਰਿਵਾਰ ਸਮੇਤ ਸ਼੍ਰੀ ਦਰਬਾਰ ਸਾਹਿਬ ਨੂੰ ਰਵਾਨਾ ਹੋ ਗਏ ਰਸਤੇ ਵਿੱਚ ਮੇਰੇ ਬੱਚਿਆਂ ਨੇ ਚਾਹ ਪੀਣ ਦੀ ਜ਼ਿੱਦ ਕੀਤੀ ਤਾਂ ਡਰਾਈਵਰ ਨੇ ਬਿਨਾਂ ਕਿਸੇ ਰੋਕ ਟੋਕ ਤੋਂ ਗੱਡੀ ਰੋਕੀ ਅਤੇ ਸਾਨੂੰ ਢਾਬੇ 'ਤੇ ਬੈਠ ਕੇ ਚਾਹ ਪਾਣੀ ਪਿਲਾਇਆ ਅਤੇ ਅਸੀਂ ਅੱਗੇ ਨੂੰ ਵਧੇ ਡਰਾਇਵਰ ਦਾ ਬਿਹੇਵ ਐਨਾ ਵਧੀਆ ਸੀ ਕਿ ਉਸਨੇ ਬਹੁਤ ਹੀ ਠਰਮੇ ਨਾਲ ਗੱਡੀ ਚਲਾਈ ਅਤੇ ਸਾਰੇ ਰੂਲ ਫੋਲੋ ਕੀਤੇ ਅਤੇ ਮੈਂ ਅਤੇ ਮੇਰੀ ਮਿਸਿਜ਼ ਗੱਲ ਕਰਦੇ ਸੀ ਵੀ ਜਦੋਂ ਕਦੇ ਅੱਗੇ ਜਾਣਾ ਤਾਂ ਅਸੀਂ ਇਸ ਕੈਬ ਨੂੰ ਬੁੱਕ ਕਰ ਸਕਦੇ ਹਾਂ ਇਸ ਨਾਲ ਆਪਣੀ ਵੀ ਸੇਫਟੀ ਹੈ ਅਤੇ ਆਪਣੇ ਬੱਚਿਆਂ ਦੀ ਵੀ ਸੇਫਟੀ ਹੈ